ਪੰਜਾਬ ਵਿੱਚ ਜ਼ਿਲ੍ਹਾ ਬਰਨਾਲਾ ਬਹੁਤ ਸਾਰੀਆਂ ਮਨੋਰੰਜਕ ਗਤੀਵਿਧੀਆਂ ਦੀ ਪੇਸ਼ਕਸ਼ ਕਰਦਾ ਹੈ ਜੋ ਇਸਦੀ ਸੱਭਿਆਚਾਰਕ ਵਿਰਾਸਤ ਅਤੇ ਸਥਾਨਕ ਪਰੰਪਰਾਵਾਂ ਨੂੰ ਦਰਸਾਉਂਦਾ ਹੈ ਕੁਝ ਗਤੀਵਿਧੀਆਂ ਅਤੇ ਆਕਾਰਸ਼ਨਾਂ ਵਿੱਚ ਸ਼ਾਮਿਲ ਹਨ ਬਰਨਾਲਾ ਵੱਖ ਵੱਖ ਪਰੰਪਗ ਗਤ ਪੰਜਾਬੀ ਤਿਉਹਾਰਾਂ ਜਿਵੇਂ ਕਿ ਵਿਸਾਖੀ ਲੋਹੜੀ ਅਤੇ ਦਿਵਾਲੀ ਦੀ ਮੇਜ਼ਬਾਨੀ ਕਰਦਾ ਹੈ ਜਿਸ ਵਿੱਚ ਲੋਕ ਪ੍ਰਦਰਸ਼ਨ ਸਥਾਨਕ ਪਕਵਾਨ ਅਤੇ ਭਾਈਚਾਰਕ ਜਸ਼ਨ ਸ਼ਾਮਿਲ ਹੁੰਦੇ ਹਨ ਜ਼ਿਲ੍ਹੇ ਵਿੱਚ ਕਈ ਇਤਿਹਾਸਿਕ ਗੁਰਦੁਆਰੇ ਹਨ ਜਿਵੇਂ ਕਿ ਗੁਰਦੁਆਰਾ ਨਾਨਕਸਰ ਜੋ ਅਧਿਆਤਮਿਕ ਸੈਰ ਸਪਾਟਾ ਅਤੇ ਸਿੱ ਸੱਭਿਆਚਾਰ ਵਿੱਚ ਦਿਲਚਸਪੀ ਰੱਖਣ ਵਾਲੇ ਸੈਲਾਨੀਆਂ ਨੂੰ ਆਕਰਸ਼ਿਤ ਕਰਦੇ ਹਨ ਸਾਲਾਨਾ ਮੇਲਿਆਂ ਅਤੇ ਸਥਾਨਕ ਬਾਜ਼ਾਰਾਂ ਵਰਗੇ ਸਮਾਗਮਾਂ ਵਿੱਚ ਜੀਵੰਤ ਮਾਹੌਲ ਪ੍ਰਦਾਨ ਕਰਦੇ ਹਨ ਜਿੱਥੇ ਸੈਲਾਨੀ ਰਵਾਇਤੀ ਪੰਜਾਬੀ ਸ਼ਿਲਪਕਾਰੀ ਸੰਗੀਤ ਭੋਜਨ ਦਾ ਅਨੁਭਵ ਕਰ ਸਕਦੇ ਹਨ ਸਥਾਨਕ ਖੇਡ ਸਮਾਗਮ ਖਾਸ ਤੌਰ 'ਤੇ ਰਵਾਇਤੀ ਖੇਡਾਂ ਜਿਵੇਂ ਕਿ ਕਬੱਡੀ ਪ੍ਰਸਿੱਧ ਹਨ ਮਨੋਰੰਜਨ ਦੇ ਨਾਲ ਨਾਲ ਕਮਿਊਨਿਟੀ ਨਾਲ ਜੁੜਨ ਦਾ ਮੌਕਾ ਪ੍ਰਦਾਨ ਕਰਦੇ ਹਨ ਇਹ ਗਤੀਵਿਧੀਆਂ ਸੱਭਿਆਚਾਰਕ ਅਧਿਆਤਮਿਕ ਅਤੇ ਮਨੋਰੰਜਕ ਤਜ਼ਰਬਿਆ ਦਾ ਮਿਸ਼ਰਣ ਪ੍ਰਦਾਨ ਕਰਦੀਆਂ ਹਨ ਬਰਨਾਲਾ ਨੂੰ ਅਮੀਰ ਸਥਾਨਕ ਪਰੰਪਰਾਵਾਂ ਅਤੇ ਭਾਈਚਾਰਕ ਜੀਵਨ ਨਾਲ ਇੱਕ ਜੀਵਤ ਜ਼ਿਲ੍ਹਾ ਬਣਾਉਂਦੀਆਂ ਹਨ